ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਯੂਨੀਸੈਕ ਹੀ ਹੈ ਸਰ ਹਾਂਜੀ ਹਾਂਜੀ ਸਰ ਪਹਿਲੇ ਇੱਦਾਂ ਨਾ ਵੀ ਅਰਲੀ ਮੋਰਨਿੰਗ ਪੰਜ ਵਜੇ ਤੋਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਵਾ ਪੰਜ ਤੋਂ ਲੈ ਕੇ ਸੱਤ ਵਜੇ ਤੱਕ ਦੋ ਬੈਚ ਹੈਗੇ ਜੀ ਉਸ ਤੋਂ ਬਾਅਦ ਆਫਟਰਨੂਨ ਦੇ ਵਿੱਚ ਵੀ ਸਾਡੇ ਲੈ ਲਉ ਕਿ ਸਾਢੇ ਦਸ ਵਜੇ ਤੋਂ ਲੈ ਕੇ ਡੇਢ ਵਜੇ ਤੱਕ ਕਲਾਸ ਹੈ ਅਤੇ ਉਹ ਤੋਂ ਬਾਅਦ ਈਵਨਿੰਗ ਨੂੰ ਸਾਢੇ ਚਾਰ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਕਲਾਸ ਹੈ ਸਰ ਹਾਂਜੀ ਹਾਂਜੀ ਨਹੀਂ ਸਰ ਇਹ ਇਹਦੇ 'ਚ ਇੱਦਾਂ ਵਾ ਨਾ ਕਿ ਦੇਖੋ ਹੁਣ ਸਾਡਾ ਯੂਨੀਸੈਕ ਜਿੰਮ ਹੈ ਅਤੇ ਸਾਡੇ ਟਰੇਨਰ ਮੇਲ ਹੀ ਹੈ ਬਟ ਉਹ ਜਦੋਂ ਗਰੁੱਪ ਦੇ ਵਿੱਚ ਫੀਮੇਲਸ ਵੀ ਹੈਗੀਆਂ ਵਾ ਅਤੇ ਜੈਂਟਸ ਵੀ ਹੈਗੇ ਆ ਵਾ ਹੈ ਨਾ ਜੇ ਤੁਸੀਂ ਚਾਹੁੰਨੇ ਕਿ ਪਰਟੀਕੁਲਰ ਇੱਕੋ ਹੀ ਮਤਲਬ ਕਿ ਇਕੱਲੀਆਂ ਫੀਮੇਲਸ ਹੋਣ ਤਾਂ ਉਹਦੇ ਵਾਸਤੇ ਮੈਂ ਉਹਨਾਂ ਨੂੰ ਦੁਪਹਿਰ ਦੇ ਜਿਹੜਾ ਟਾਈਮ ਹੈਗਾ ਜੇ ਉਹ ਸੁਟੇਅਬਲ ਹੈਗਾ ਅਤੇ ਉਹ ਅਵੇਲੇਬਲ ਹੈ ਉੱਥੇ ਸਿਰਫ ਫੀਮੇਲ ਹੀ ਹੈਗੀਆਂ ਵਾ ਹੈ ਨਾ ਈਵਨਿੰਗ ਅਤੇ ਮੋਰਨਿੰਗ ਦੇ ਵਿੱਚ ਮਿਕਸ ਹੈ ਸਰ ਹਾਂਜੀ ਹਾਂਜੀ ਸਰ ਯੋਗਾ ਤਾਂ ਦੇਖੋ ਜੀ ਭਾਵੇਂ ਵੇਟ ਲੂਜ ਕਰਨਾ ਹੋਵੇ ਭਾਵੇਂ ਗੇਨ ਕਰਨਾ ਹੋਵੇ ਹਰ ਚੀਜ਼ ਲਈ ਬੈਟਰ ਹੈ ਅਤੇ ਇਹ ਪਰਮਾਨੈਂਟ ਹੀ ਹੈ ਜੀ ਜੇ ਤੁਸੀਂ ਉੱਦਾਂ ਜਿਮ ਥਰੂ ਕਰਦੇ ਹੋ ਤਾਂ ਉਹ ਤੁਹਾਡਾ ਟੈਂਪਰੇਰੀ ਹੋ ਸਕਦਾ ਹੈ ਪਰ ਯੋਗਾ ਥਰੂ ਮਤਲਬ ਤੁਹਾਡਾ ਪਰਮਾਨੈਂਟ ਹੋ ਜਾਵੇਗਾ ਸਰ ਫੀਸ ਸਰ ਮੰਥ ਸਰ ਜੇ ਤੁਸੀਂ ਪੂਰੇ ਸਾਲ ਦੀ ਲੈਣੀ ਹੈ ਫਿਰ ਤਾਂ ਵੀਹ ਹਜ਼ਾਰ ਹੈ ਜੀ ਜੇ ਤੁਸੀਂ ਮੰਥਲੀ ਪੇਅ ਕਰਨੀ ਹੈ ਫਿਰ ਦੋ ਹਜ਼ਾਰ ਰੁਪਿਆ ਜੀ ਓਕੇ ਸਰ ਓਕੇ ਥੈਂਕ ਯੂ ਸਰ